ਹੈਲੋ ਵਧੀਆ ਜੀ ਵਧੀਆ ਤੁਸੀਂ ਸੁਣਾਓ ਹਾਂਜੀ ਬੋਲੋ ਜੀ ਹਾਂਜੀ ਹਾਂਜੀ ਹਾਂਜੀ ਗ੍ਰੀ ਗ੍ਰੀਨ ਰੈਵੇਲੀਊਸ਼ਨ ਦਾ ਪਤਾ ਹੋਊਗਾ ਹਰੀ ਕ੍ਰਾਂਤੀ ਉਹ ਹਰੀ ਕ੍ਰਾਂਤੀ ਜੀ ਮਤਲਬ ਫ਼ਸਲਾਂ ਦਾ ਝਾੜ ਵੱਧ ਜਾਂਦਾ ਉਪਜ ਵੱਧ ਜਾਂਦੀ ਹੈ ਏ ਆਪਣਾ ਉਹ ਕੈਮੀਕਲ ਫਰਟੀਲਾਈਜ਼ਰ ਵਗੈਰਾ ਯੂਜ਼ ਕਰੋ ਉਹਦੇ ਨਾਲ ਹਾਂ ਹਾਂ ਉਹਦੇ ਨਾਲ ਉਪਜ ਵਧੂਗੀ ਦਾਣੇ ਵੱਧ ਆਣਗੇ ਫਸਲਾਂ 'ਚ ਕਣਕਾਂ 'ਚ ਇਹ ਜੀ ਤੁਸੀਂ ਜਿਵੇਂ ਕੈਮੀਕਲ ਫਰਟੀਲਾਈਜ਼ਰ ਵਰਤ ਲਓ ਜਿਵੇਂ ਕਿ ਐੱਨ ਪੀ ਕੇ ਹੋ ਗਿਆ ਨਾਈਟ੍ਰੋਜਨ ਫੋਸਫੋਰਸ ਪੋਟਾਸ਼ੀਅਮ ਅਤੇ ਕੁਝ ਪੈਸਟੀਸਾਈਡ ਵਰਤ ਲਓ ਜਿਵੇਂ ਕਿ ਉਹ ਪੈ ਜਾਂਦੀਆਂ ਸੁੰਡੀਆਂ ਸਾਂਡੀਆਂ ਫ਼ਸਲਾਂ ਨੂੰ ਉਸ ਤੋਂ ਦੂਰ ਉਸ ਤੋਂ ਬਚਾਵੇਗਾ ਜਿਵੇਂ ਡੀ ਡੀ ਟੀ ਡੀ ਡੀ ਈ ਤੇ ਹਾਈ ਕੁਆਲਟੀ ਸੀਡਸ ਵਰਤੋਂ ਐੱਚ ਵਾਈ ਵੀ ਹਾਈ ਹੀਡਿੰਗ ਵਰਾਇਟੀ ਸੀਡਸ ਐੱਚ ਵਾਈ ਵੀ ਵੀ ਇਹ ਨਾ ਸਿੰਪਲ ਇਕ ਤਾਂ ਹੁੰਦੀ ਹੈ ਸਿੰਪਲ ਕੁਆਲਟੀ ਬੀਜਾਂ ਦੀ ਇਕ ਐੱਚ ਵਾਈ ਵੀ ਹੁੰਦੇ ਹੈ ਉਹ ਥੋੜ੍ਹੇ ਮਹਿੰਗੇ ਹੁੰਦੇ ਹੈ ਇਕ ਤਾਂ ਇਕ ਡੇਢ ਰੁਪਏ ਕਿਲੋ ਹੁੰਦੇ ਇਕ ਹੁੰਦੇ ਹੈ ਦੋ ਚਾਰ ਰੁਪਏ ਕਿਲੋ ਉਹ ਵ ਵਧੀਆ ਹੁੰਦੇ ਹੈ ਦੋ ਚਾਰ ਰੁਪਏ ਵਾਲੇ ਐੱਚ ਵਾਈ ਵੀ ਉਹ ਤਾਂ ਓ ਖਰੀਦ ਲਓ ਮੰਡੀ ਜਾ ਕੇ ਅਤੇ ਇਕ ਆਪਣੀ ਇਰੀਗੇਸ਼ਨ ਫੈਸੀਲਿਟੀ ਫ਼ਸਲਾਂ ਨੂੰ ਪਾਣੀ ਹਿਸਾਬ ਨਾਲ ਲਾਓ ਜਿਵੇਂ ਕਿ ਡਰਿੱਪ ਇਰੀਗੇਸ਼ਨ ਯੂਜ਼ ਕਰੋ ਹਾਂਜੀ ਹਾਂਜੀ ਬਾਅਦ 'ਚ ਭਾਵੇਂ ਮਿਲ ਲਿਓ ਆ ਕੇ ਜੀ ਕੋਈ ਦਿੱਕਤ ਨਹੀਂ